ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਸਿਮਰਪ੍ਰੀਤ ਸਿੰਘ ਹੈ ਮੈਂ ਆਪਣੇ ਪਰਿਵਾਰ ਨਾਲ ਇੱਕ ਸੜਕ ਯਾਤਰਾ ਦੀ ਯੋਜਨਾ ਬਣਾ ਰਿਹਾ ਹਾਂ ਜਿਸ ਲਈ ਮੈਨੂੰ ਇੱਕ ਗੱਡੀ ਦੀ ਜ਼ਰੂਰਤ ਹੈ ਅਸੀਂ ਕੁਲ ਛੇ ਪਰਿਵਾਰ ਦੇ ਮੈਂਬਰ ਹਾਂ ਅਸੀਂ ਛੇ ਜਣਿਆਂ ਨੇ ਜਾਣਾ ਹੈ ਅਤੇ ਇਸ ਲਈ ਸਾਨੂੰ ਇੱਕ ਵੱਡੀ ਗੱਡੀ ਜਿਵੇਂ ਕਿ ਆਰਟੀਕਾ ਇਨੋਵਾ ਆਦਿ ਦੀ ਜ਼ਰੂਰਤ ਹੈ ਅਸੀਂ ਪਟਿਆਲੇ ਤੋਂ ਰਾਮਪੁਰ ਤੱਕ ਯਾਤਰਾ ਕਰਨੀ ਹੈ ਤੁਸੀਂ ਮੈਨੂੰ ਜਾਣਕਾਰੀ ਦੇਵੋ ਕਿ ਤੁਹਾਡੇ ਕੋਲ ਕਿਹੜੀ ਕਿਹੜੀ ਗੱਡੀ ਕਿਰਾਏ 'ਤੇ ਦੇਣ ਲਈ ਮੌਜੂਦ ਹੈ ਅਤੇ ਨਾਲ ਹੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਜਾਂ ਪ੍ਰਤੀ ਦਿਨ ਦੇ ਹਿਸਾਬ ਨਾਲ ਕਿੰਨਾ ਕਿਰਾਇਆ ਹੈ ਉਸ ਦੀ ਵੀ ਜਾਣਕਾਰੀ ਦਿਓ ਅਸੀਂ ਕੁੱਲ ਇੱਕ ਹਫ਼ਤੇ ਲਈ ਯਾਨੀ ਕਿ ਸੱਤ ਦਿਨਾਂ ਲਈ ਯਾਤਰਾ ਕਰਨੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਨਾਲ ਹੀ ਕੁਝ ਛੂਟ ਵੀ ਦੇਵੋ ਤਾਂ ਜੋ ਅਸੀਂ ਇਹ ਯਾਤਰਾ ਨੂੰ ਆਨੰਦਮਈ ਢੰਗ ਨਾਲ ਕਰ ਸਕੀਏ